ਪੰਜਾਬੀ ਭਾਸ਼ਾ ਭਾਰਤ ਦੇ ਉੱਤਰੀ ਹਿੱਸਿਆਂ 'ਚ ਜ਼ਿਆਦਾ ਬੋਲੀ ਜਾਂਦੀ ਹੈ ਅਤੇ ਇਹਨਾਂ ਦਾ ਜਿਹੜਾ ਪੰਜਾਬੀ ਭਾਸ਼ਾ ਦਾ ਸੰਚਾਰ ਹੈ ਇਹ ਵੀ ਕਾਫੀ ਅੱਛਾ ਹੈ ਕਿਉਂਕਿ ਜਿਹੜੇ ਨਾਲ ਦੇ ਪੰਜਾਬ ਦੇ ਨਾਲ ਦੀਆਂ ਰਾਜ ਨੇ ਜਿਵੇਂ ਕਿ ਹਰਿਆਣਾ ਹਿਮਾਚਲ ਦਿੱਲੀ ਅਤੇ ਰਾਜਸਥਾਨ ਦਾ ਕੁਛ ਏਰੀਆ ਇੱਥੇ ਪੰਜਾਬੀ ਕਾਫੀ ਬੋਲੀ ਅਤੇ ਸਮਝੀ ਜਾਂਦੀ ਹੈ ਅਤੇ ਆਪਸ ਵਿੱਚ ਜਿਹੜੇ ਲੋਕਾਂ ਦੀ ਕਮਿਊਨੀਕੇਸ਼ਨ ਹੈ ਵਿਚਾਰ ਵਟਾਂਦਰੇ ਨੇ ਇਹ ਵੀ ਪੰਜਾਬੀ ਵਿੱਚ ਹੀ ਹੁੰਦੇ ਨੇ